ਅਸੀਂ ਸਿੱਖ ਧਰਮ ਨਾਲ ਸੰਬੰਧਿਤ ਹਾਂ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਹਾਂ ਅਸੀਂ ਇਹ ਨਹੀਂ ਹੈਗਾ ਵੀ ਮਤਲਬ ਕਿਸੇ ਧਰਮ ਨੂੰ ਮਤਲਬ ਮਾੜਾ ਕਹਿੰਦੇ ਹਾਂ ਅਸੀਂ ਸਾਰੇ ਹੀ ਧਰਮਾਂ ਦੇ ਆਦਰ ਸਤਿਕਾਰ ਕਰਦੇ ਹਾਂ ਉਹਨਾਂ ਤੋਂ ਮਤਲਬ ਦੂਜੇ ਧਰਮ ਆ ਜਿਹੜੇ ਸਿੱਖਿਆ ਮਿਲਦੀ ਆ ਸਾਨੂੰ ਜਿਵੇਂ ਦੁਸਹਿਰਾ ਹੋ ਗਿਆ ਉਹ ਆਪਣਾ ਹੈਗਾ ਸ਼ਾਂਤੀ ਮਤਲਬ ਹੈਗਾ ਵਧੀਆ ਅਤੇ ਢੰਗ ਨਾਲ ਮਨਾਉਂਦੇ ਹਾਂ ਬੱਚੇ ਜਾਂਦੇ ਨੇ ਦਿਵਾਲੀ ਆ ਉਹ ਮ ਬੱਚੇ ਇੰਜੋਏ ਕਰਦੇ ਆ ਪੂਰੇ ਹੀ ਸਾਰੇ ਤਿਉਹਾਰ ਅਸੀਂ ਵਧੀਆ ਐਨ ਸਾਰੇ ਧਰਮਾਂ ਦੇ ਹੀ ਤਿਉਹਾਰ ਮਨਾਉਂਦੇ ਹਾਂ ਅਸੀਂ ਮਤਲਬ ਸਾਰੇ ਤਿਹਾ ਅ ਧਰਮ ਸਾਨੂੰ ਵਧੀਆ ਹੀ ਲੱਗਦੇ ਨੇ ਕੋਈ ਇਹੋ ਜਿਹਾ ਨਹੀਂ ਹੈਗਾ ਵੀ ਕੋਈ ਧਰਮ ਮਾੜਾ ਲੱਗਦਾ ਸਾਰੇ ਹੀ ਵਧੀਆ ਨੇ ਜੀ